ਭਾਰਤ ਵਿੱਚ ਵੱਖ ਵੱਖ ਤਰ੍ਹਾਂ ਦੇ ਮੌਸਮ ਹੁੰਦੇ ਹਨ ਜਿਵੇਂ ਸਰਦੀ ਗਰਮੀ ਪੱਤਝੜ ਬਰਸਾਤ ਅਤੇ ਮਿੱਠਾ ਮੌਸਮ ਇਸ ਵਕਤ ਭਾਰਤ ਵਿੱਚ ਠੰਡ ਦਾ ਮੌਸਮ ਚੱਲ ਰਿਹਾ ਹੈ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਵੱਖ ਵੱਖ ਮੌਸਮ ਹੁੰਦੇ ਹਨ ਜਿਵੇਂ ਸ਼੍ਰੀਨਗਰ ਵਿੱਚ ਬਰਫ਼ ਜੰਮੀ ਰਹਿੰਦੀ ਹੈ ਪਹਾੜੀ ਇਲਾਕੇ ਵਿੱਚ ਜਿਵੇਂ ਹੇਮਕੁੰਟ ਸ਼ਿਮਲਾ ਬਦਰੀਨਾਥ ਅਮਰਨਾਥ ਸਾਰੇ ਰਸਤੇ ਬਰਫ਼ਾਂ ਕਰਕੇ ਬੰਦ ਹੋ ਜਾਂਦੇ ਹਨ ਕਈ ਥਾਵਾਂ 'ਤੇ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਜਿਵੇਂ ਪੰਜਾਬ ਦਿੱਲੀ ਹਰਿਆਣਾ ਕਈ ਥਾਵਾਂ ਵਿੱਚ ਠੰਡ ਨਹੀਂ ਪੈਂਦੀ ਜਿਵੇਂ ਮਹਾਰਾਸ਼ਟਰ ਕਲਕੱਤਾ ਬਿਹਾਰ ਆਦਿ ਬੰਬੇ ਸਮੁੰਦਰ ਦੇ ਕੋਲ ਹੋਣ ਕਰਕੇ ਸਾਰਾ ਸਾਲ ਇੱਕੋ ਜਿਹਾ ਹੀ ਮੌਸਮ ਰਹਿੰਦਾ ਹੈ ਯਾਨੀ ਕਿ ਮਿੱਠਾ ਮੌਸਮ ਨਾ ਸਰਦੀ ਨਾ ਗਰਮੀ